ਸਤਿ ਸ਼੍ਰੀ ਅਕਾਲ ਸਕੂਲਾਂ ਵਿੱਚ ਪੜ੍ਹਾਈ ਤੋਂ ਇਲਾਵਾ ਵੀ ਬਹੁਤ ਸਾਰੀਆਂ ਪ੍ਰਤੀਕਿਰਿਆਂ ਹੁੰਦੀਆਂ ਹਨ ਗਤੀਵਿਧੀਆਂ ਹੁੰਦੀਆਂ ਹਨ ਜਿਵੇਂ ਕਿ ਡਾਂਸ ਪ੍ਰਤਿਯੋਗਤਾ ਹੁੰਦੀਆਂ ਨੇ ਡਰੋਇੰਗ ਪ੍ਰਤਿਯੋਗਤਾ ਹੁੰਦੀਆਂ ਨੇ ਖੇਡਾਂ ਨੂੰ ਲੈ ਕੇ ਕਈ ਪ੍ਰਤਿਯੋਗਤਾ ਹੁੰਦੀਆਂ ਨੇ ਫਿਰ ਐਂਕਰਿੰਗ ਦੀਆਂ ਪ੍ਰਤਿਯੋਗਤਾ ਹੁੰਦੀਆਂ ਨੇ ਬੱਚਿਆਂ ਨੂੰ ਸਟੇਜ 'ਤੇ ਕੰਪੀਟੀਸ਼ਨ ਲੈਵਲ 'ਤੇ ਬੋਲਣਾ ਸਿਖਾਇਆ ਜਾਂਦਾ ਆ ਉਹਨਾਂ ਦਾ ਆਤਮ ਸ ਆਤਮ ਵਿਸ਼ਵਾਸ ਵਧਾਇਆ ਜਾਂਦਾ ਆ ਜਿੱਦਾਂ ਕਿ ਸਕੂਲਾਂ ਵਿੱਚ ਰੋਜ਼ਾਨਾ ਬੱਚੇ ਜਿਹੜੇ ਸਪੀਚ ਦਿੰਦੇ ਆ ਜਾਂ ਫਿਰ ਸਟੇਜ ਨੂੰ ਰਿਪ੍ਰਜੈਂਟ ਕਰਦੇ ਆ ਉਹ ਉਹਨਾਂ ਦੇ ਥਰੂ ਉਹਨਾਂ ਦਾ ਜਿਹੜਾ ਆ ਉਹਨਾਂ ਦਾ ਆਤਮ ਵਿਸ਼ਵਾਸ ਉਹ ਬਹੁਤ ਜ਼ਿਆਦਾ ਹੀ ਵਧਦਾ ਆ ਅਤੇ ਹੋਰ ਵੀ ਬਾਕੀ ਪ੍ਰਤਿਯੋਗਤਾ ਨਾਲ ਵੀ ਉਹਨਾਂ ਦਾ ਆਤਮ ਸ ਆਤਮ ਵਿਸ਼ਵਾਸ ਵਧਦਾ ਹੈ ਜਿੱਦਾਂ ਕਿ ਜਿਹੜੇ ਬੱਚੇ ਡਰਾਇੰਗ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੇ ਆ ਉਹਨਾਂ ਨੂੰ ਆਪਣਾ ਵਾਧਾ ਲੱਗਦਾ ਆ ਕਿ ਨਹੀਂ ਇਸ ਇਹਦੇ 'ਚ ਮੈਂ ਵਧੀਆ ਹੈਗਾ ਆ ਜਿਹੜੇ ਡਾਂਸ 'ਚ ਵਧੀਆ ਉਹਨਾਂ ਨੂੰ ਡਾਂਸ ਦਾ ਵਧੀਆ ਫੀਲ ਹੁੰਦਾ ਆ ਅਤੇ ਜਿਹੜੇ ਖੇਡਾਂ 'ਚ ਆਏ ਆ ਖੇਡਾਂ 'ਚ ਵਧੀਆ ਨੇ ਉਹ ਫਿਰ ਖੇਡਾਂ ਨੂੰ ਹੀ ਲੈ ਕੇ ਅੱਗੇ ਵੱਧ ਸਕਦੇ ਆ ਤਾਂ ਸਕੂਲ ਇਹ ਬਹੁਤ ਵਧੀਆ ਇੱਕ ਹੈਗਾ ਆ ਬੱਚਿਆਂ ਨੂੰ ਦੱਸਣ ਲਈ ਕਿ ਉਹਨਾਂ ਵਿੱਚ ਕੀ ਖੂਬੀਆਂ ਹੈਗੀਆਂ ਨੇ